ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਅੱਜ ਕਿੱਦਾਂ ਯਾਦ ਕੀਤਾ ਹੋਰ ਸਿਹਤ ਠੀਕ ਹੈ ਜੀ ਬਸ ਘਰ ਹੀ ਆ ਆਪਾਂ ਕਿੱਥੇ ਜਾਣਾ ਹਾਂਜੀ ਅੱਜ ਵੈਸੇ ਹੀ ਹੈ ਨਾ ਬੱਚੇ ਤੁਹਾਡਾ ਨਾਮ ਲੈ ਰਹੇ ਸੀਗੇ ਕਹਿ ਰਹੇ ਸੀ ਕਿ ਆਂਟੀ ਘਰ ਜਾਣਾ ਅਤੇ ਮੈਂ ਸੋਚਿਆ ਪਹਿਲਾਂ ਆਂਟੀ ਨੂੰ ਪੁੱਛ ਹੀ ਲਈਏ ਘਰ ਵੀ ਹੋਣਗੇ ਅੱਛਾ ਜੀ ਕੀ ਬਣਾ ਰਹੇ ਹੋ ਜ਼ਰੂਰ ਜ਼ਰੂਰ ਜ਼ਰੂਰ ਠੀਕ ਹੈ ਹਾਂ ਪਹਿਲਾਂ ਵੀ ਅਸੀਂ ਇੱਕ ਦਿਨ ਆਉਣਾ ਚਾਹਿਆ ਸੀਗਾ ਅਤੇ ਅਸੀਂ ਸਾਨੂੰ ਰਸਤੇ ਵਿੱਚੋਂ ਮੁੜਨਾ ਪਿਆ ਭੈਣ ਜੀ ਇੰਨਾ ਟਰੈਫਿਕ ਇੰਨਾ ਰੱਸ਼ ਕਿਤੇ ਗੱਡੀਆਂ ਹੀ ਗੱਡੀਆਂ ਹਾਂ ਉਹ ਰੋਡ ਖਰਾਬ ਸੀ ਪਤਾ ਨਹੀਂ ਕੀ ਪ੍ਰੋਬਲਮ ਸੀਗੀ ਉੱਥੇ ਅਤੇ ਬਸ ਅਸੀਂ ਤਾਂ ਵਾਪਸ ਹੀ ਆ ਗਏ ਘਰ ਘਰ ਨੂੰ ਹਾਂਜੀ ਹਾਂਜੀ ਅੱਛਾ ਜੀ ਓ ਹੋ ਅੱਛਾ ਜੀ ਓ ਹੋ ਨਹੀਂ ਇਹ ਮੇਨ ਸ਼ਹਿਰ ਆ ਅਤੇ ਹਾਈਵੇਅ ਆ ਅਤੇ ਫਿਰ ਇੰਨਾ ਜਾਮ ਅਤੇ ਲੋਕਾਂ ਨੂੰ ਕਿੰਨੀ ਪ੍ਰੇਸ਼ਾਨੀ ਹੁੰਦੀ ਹੋਏਗੀ ਅਤੇ ਹਾਂ ਅੱਛਾ ਜੀ ਹਾਂ ਨਹੀਂ ਤਾਂ ਇਹਦੇ ਨਾਲ ਆਵਾਜਾਈ ਤਾਂ ਬਹੁਤ ਪ੍ਰਭਾਵਿਤ ਹੁੰਦੀ ਹੈ ਅਤੇ ਅਤੇ ਇਹ ਤਾਂ ਹੁਣ ਟਰੈਫਿਕ ਪੁਲਿਸ ਵਾਲਿਆਂ ਨੂੰ ਚਾਹੀਦਾ ਕਿ ਨਾ ਵੀ ਸ਼ਹਿਰ ਦਾ ਰਸਤਾ ਉਹਨਾਂ ਨੂੰ ਵੱਖਰਾ ਦੇਣ ਹੈ ਨਾ ਕੋਈ ਹਾਂ ਅੱਛਾ ਹਾਂ ਨਹੀਂ ਨਹੀਂ ਇੱਦਾਂ ਤਾਂ ਟਾਈਮ ਬਹੁਤ ਲੱਗ ਜਾਂਦਾ ਆ ਸਾਨੂੰ ਵਾਪਿਸ ਆਉਣਾ ਪਿਆ ਅਤੇ ਦੂਰੋਂ ਤੋਂ ਆਉਣ ਵਾਲੇ ਲੋਕਾਂ ਨੂੰ ਕਿੰਨੀ ਮੁਸ਼ਕਿਲ ਹੁੰਦੀ ਹੋਏਗੀ ਹਾਂਜੀ ਉਹ ਤਾਂ ਜ਼ਰੂਰ ਲੇਟ ਹੁੰਦੇ ਹੋਣਗੇ ਅੱਛਾ ਅੱਛਾ ਜੀ ਨਹੀਂ ਭਲਾ ਹੋਰ ਕੋਈ ਰਸਤਾ ਹੈਗਾ ਤੁਹਾਡੇ ਅੱਛਾ ਜੀ ਹਾਂ ਹਾਂ ਹਾਂ ਅੱਛਾ ਜੀ ਅਤੇ ਇਹ ਮੇਰਾ ਖਿਆਲ ਹੈ ਕਿ ਦੁਪਹਿਰ ਦਾ ਟਾਈਮ ਸਹੀ ਰਹੇਗਾ ਨਾ ਸਵੇਰੇ ਸ਼ਾਮ ਦਾ ਹੁੰਦੀ ਹੋਏਗੀ ਹੈ ਨਾ ਅਤੇ ਅੱਛਾ ਜੀ ਹਾਂ ਨਹੀਂ ਨਹੀਂ ਬਹੁਤ ਸੜਕਾਂ ਦਾ ਵੀ ਬਹੁਤ ਬੁਰਾ ਹਾਲ ਆ ਅਤੇ ਟਰੈਫਿਕ ਵੀ ਬਹੁਤ ਵੱਧ ਗਿਆ ਆ ਅਤੇ ਇੱਕ ਸਟੇਸ਼ਨ ਬਣ ਰਿਹਾ ਅਤੇ ਹੈ ਨਾ ਬਹੁਤ ਮੁਸ਼ਕਿਲ ਆਉਂਦੀ ਹੈ ਅਤੇ ਮੈਂ ਚਾਹੁੰਦੀ ਸੀਗੀ ਵੀ ਜਾਣਾ ਆ ਤਾਂ ਫਿਰ ਕਿੱਦਾਂ ਇਹ ਨਾ ਹੋਵੇ ਵੀ ਸਾਡੇ ਵੀ ਟਾਈਮ ਵੇਸਟ ਹੋਵੇ ਅਸੀਂ ਤੁਹਾਨੂੰ ਮਿਲ ਹੀ ਨਾ ਸਕੀਏ ਹੈ ਨਾ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਜੀ ਹਾਂ ਠੀਕ ਹੈ ਹਾਂਜੀ ਹਾਂਜੀ ਸਭ ਠੀਕ ਠਾਕ ਕੋਈ ਨਹੀਂ ਬਾਕੀ ਗੱਲਾਂ ਆਪਾਂ ਮਿਲ ਕੇ ਕਰਾਂਗੇ ਹੈ ਚਲੋ ਜੀ ਅਸੀਂ ਕੱਲ੍ਹ ਆ ਰਹੇ ਹਾਂ ਜੀ ਠੀਕ ਹੈ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ